ਮੈਨੂੰ ਨਹੀਂ ਪਤਾ ਦੇਖ ਲਓ ਪੰਜਾਬ ਦੇ ਵਿੱਚ ਸਿੱਖਿਆ ਦੇ ਵਿੱਚ ਸੁਧਾਰ ਕਰਨ ਦੇ ਲਈ ਸਰਕਾਰੀ ਪਹਿਲ ਕਦਮੀਆਂ ਜਾਂ ਨੀਤੀਆਂ ਬਹੁਤ ਹੀ ਉੱਦਮ ਤਰੀਕੇ ਨਾਲ ਆਪਣਾ ਕੰਮ ਕਰ ਰਹੀਆਂ ਨੇ ਜਿਸ ਦੇ ਵਿੱਚ ਫੰਡਿੰਗ ਅਧਿਆਪਕ ਸਿਖਲਾਈ ਕਰੀਕੁਲਮ ਭਾਵ ਪਟਕਰਮ ਦੇ ਵਿੱਚ ਬਹੁਤ ਹੀ ਜ਼ਿਆਦਾ ਸੁਧਾਰ ਕੀਤਾ ਗਿਆ ਹੈ ਅਸ਼ ਟੇਕ ਕੇ ਕਿਸਮ ਦੇ ਜਿਹੜੇ ਸਕੋਲਰਸ਼ਿਪ ਨੇ ਉਹ ਵਿਦਿਆਰਥੀਆਂ ਨੂੰ ਮਿਲਦੇ ਨੇ ਜਿਵੇਂ ਕਿ ਜਨ ਧਨ ਯੋਜਨਾ ਰਾਜ ਸਭਾ ਐਮ ਰਾਸ਼ਟਰੀਯ ਮਾਧਿਮਿਕ ਸਿਖਸ਼ਾ ਅਭਿਆਨ ਇਹਦੇ ਵਿੱਚ ਜੋ ਸਾਨੂੰ ਅਧਿਆਪਕ ਸਿਖਲਾਈ ਦਿੱਤੀ ਜਾ ਰਹੀ ਹੈ ਬੀਐਡ ਦੀਆਂ ਕਲਾਸਾਂ ਲੱਗਦੀਆਂ ਹਨ ਉਸ ਤੋਂ ਬਾਅਦ ਸਾਡੇ ਕੋਲ ਵਿਦਿਆਰਥੀਆਂ ਨੂੰ ਈ ਟੀ ਟੀ ਭਾਵ ਜੇ ਬੀ ਟੀ ਜੂਨੀਅਰ ਬੈਸਿਕ ਟਰੇਨਿੰਗ ਭਾਵ ਈ ਟੀ ਟੀ ਐਲੀਮੈਂਟਰੀ ਐਜੂਕੇਸ਼ਨ ਉਹ ਦਿੱਤੀ ਜਾ ਰਹੀ ਆ ਜਿਹਦੇ ਨਾਲ ਕਿ ਸਾਡੀ ਵਿਦਿਆਰਥੀ ਬਹੁਤ ਹੀ ਜ਼ਿਆਦਾ ਕਾਬਲ ਬਣ ਕੇ ਨਿਕਲਦੇ ਹਨ ਇਸ ਤੋਂ ਇਲਾਵਾ ਵਜੀਫੇ ਵਿਦਿਆਰਥੀਆਂ ਨੂੰ ਕਈ ਕਿਸਮ ਦੇ ਵਜੀਫੇ ਦਿੱਤੇ ਜਾਂਦੇ ਹਨ ਜਿਹਦੇ ਵਿੱਚ ਕਿ ਬੀ ਆਰ ਅੰਬੇਦਕਰ ਵਜੀਫਾ ਰਾਣੀ ਲਕਸ਼ਮੀ ਬਾਈ ਵਜੀਫਾ ਅਤੇ ਉਸ ਤੋਂ ਬਾਅਦ ਬੀ ਸੀ ਵਿਦਿਆਰਥੀਆਂ ਨੂੰ ਵਜੀਫਾ ਉਸ ਤੋਂ ਬਾਅਦ ਐ ਸੀ ਵਿਦਿਆਰਥੀਆਂ ਨੂੰ ਵਜੀਫਾ ਜਿਹਦੇ ਵਿੱਚ ਕਿ ਨਾਲ ਹੀ ਸਾਡੇ ਕੋਲ ਬਹੁਤ ਹੀ ਜਿਹੜੇ ਘੱਟ ਗਿਣਤੀ ਦੇ ਐਮ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਵਜੀਫਾ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਜੋ ਵਜੀਫੇ ਨੇ ਐਨ ਐਮ ਐਮ ਐਸ ਦਾ ਅਗਰ ਵਿਦਿਆਰਥੀ ਬੱਚਾ ਪੇਪਰ ਪਾਸ ਕਰ ਲੈਂਦਾ ਹੈ ਤਾਂ ਵਿਦਿਆਰਥੀ ਸ਼ਕੋਲਰਸ਼ਿਪ ਪ੍ਰਾਪਤ ਕਰਦਾ ਹੈ ਉਸ ਤੋਂ ਬਾਅਦ ਸਾਡੇ ਕੋਲ ਸੀ ਪੀ ਐਸ ਟੀ ਐਸ ਸੀ ਪੀ ਐਸ ਟੀ ਐਸ ਸੀ ਦੇ ਅਧੀਨ ਵਿਦਿਆਰਥੀਆਂ ਨੂੰ ਵਜੀਫਾ ਪ੍ਰਦਾਨ ਕੀਤਾ ਜਾਂਦਾ ਹੈ ਕਿਉਂਕਿ ਇਹ ਜਿਹੜੀ ਜੋ ਵਜੀਫੇ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਜ਼ਿਆਦਾ ਮਿਹਨਤ ਦੇ ਨਾਲ ਕੰਪੀਟੀਸ਼ਨ ਇਗਜ਼ਾਮ ਪਾਸ ਕਰਕੇ ਪ੍ਰਾਪਤ ਹੁੰਦੇ ਹਨ ਦੂਸਰਾ ਉਸ ਤੋਂ ਬਾਅਦ ਜੋ ਵਿਦਿਆਰਥੀਆਂ ਨੂੰ ਵਜੀਫਾ ਪ੍ਰਾਪਤ ਹੁੰਦਾ ਹੈ ਇਸ ਤੋਂ ਇਲਾਵਾ ਜੋ ਅਸੀਂ ਆਪਣੇ ਸਕੂਲਾਂ ਦੇ ਵਿੱਚੋਂ ਐਨ ਐਸ ਪੀ ਭਾਵ ਨੈਸ਼ਨਲ ਸਕੋਲਰਸ਼ਿਪ ਪੋਰਟਲ ਦੇ ਅੰਡਰ ਜੋ ਵਿਦਿਆਰਥੀਆਂ ਨੂੰ ਵਜੀਫਾ ਅਪਲਾਈ ਕਰਦੇ ਹਾਂ ਉਸਦੇ ਵਿੱਚ ਕਈ ਕਿਸਮ ਦੀਆ ਕੰਨਡੀਸ਼ਨ ਹੁੰਦੀਆ ਹਨ ਜਿਵੇਂ ਕਿ ਉਸ ਦੇ ਵਿੱਚ ਵਿਦਿਆਰਥੀ ਦਾ ਆਧਾਰ ਕਾਰਡ ਵਿਦਿਆਰਥੀ ਦੀ ਪਿਛਲੀ ਕਲਾਸ ਦਾ ਡੀ ਐਮ ਸੀ ਵਿਦਿਆਰਥੀ ਦਾ ਬੈਂਕ ਅਕਾਊਂਟ ਜੋ ਕਿ ਉਸ ਦਾ ਇਕੱਲੇ ਦਾ ਹੀ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਨਾਲ ਵਿਦਿਆਰਥੀ ਦਾ ਰੈਜੀਡੈਂਸ ਸਰਟੀਫਿਕੇਟ ਅਤੇ ਨਾਲ ਹੀ ਵਿਦਿਆਰਥੀ ਦਾ ਕਾਸਟ ਸਰਟੀਫਿਕੇਟ ਭਾਵ ਉਹ ਕਿਸ ਜਾਤੀ ਦੇ ਨਾਲ ਸੰਬੰਧਿਤ ਹੈ ਇਹ ਸਭ ਕਾਗਜ਼ ਦਸਤਾਵੇਜ਼ ਵਿਦਿਆਰਥੀ ਨੂੰ ਸਕੋਲਰਸ਼ਿਪ ਦਿਵਾਉਣ ਦੇ ਵਿੱਚ ਸਹਾਈ ਹੁੰਦੇ ਹਨ ਜਿਸ ਦੇ ਅਧੀਨ ਸਰਕਾਰ ਇਸ ਨੂੰ ਇੱਕ ਸਾਲ ਦਾ ਚੌਦਾ ਸੌ ਰੁਪਈਆ ਲਗਭਗ ਪ੍ਰੋਵਾਈਡ ਕਰਕੇ ਉਸਦੇ ਖਾਤੇ ਦੇ ਵਿੱਚ ਪਾਉਂਦੀ ਹੈ ਥੈਂਕ ਯੂ